ਰੋਪੜ ਦੀ ਖੁਦਾਈ ਉੱਨੀ ਸੌ ਇੱਕਵੰਜਾ ਵਿੱਚ ਵਾਈ ਡੀ ਸ਼ਰਮਾ ਨੇ ਸ਼ੁਰੂ ਕਰਵਾਈ ਸੀ ਅਤੇ ਇਸ ਵਿੱਚ ਸਿੱਧੂ ਘਾਟੀ ਸੱਭਿਅਤਾ ਦੇ ਬਹੁਤ ਸਾਰੇ ਨਿਸ਼ਾਨ ਮਿਲਦੇ ਹਨ ਇੱਥੇ ਹੜੱਪਾ ਸੱਭਿਅਤਾ ਨਾਲ ਸੰਬੰਧਿਤ ਅਜਾਇਬ ਘਰ ਵੀ ਪਾਇਆ ਗਿਆ ਹੈ ਜਿੱਥੇ ਕਿ ਪੁਰਾਤਨ ਸਮੇਂ ਵਿੱਚ ਵਰਤੇ ਜਾਂਦੇ ਮਿੱਟੀ ਦੇ ਬਰਤਨ ਗਹਿਣੇ ਭਾਂਡੇ ਤਾਂਬੇ ਦੀਆਂ ਕੁਹਾੜੀਆਂ ਪੁਰਾਣੇ ਮਕਾਨ ਜੋ ਕਿ ਪੱਥਰਾਂ ਦੇ ਬਣੇ ਹੋਏ ਸਨ ਆਦਿ ਚਿੱਤਰਾਂ ਨੂੰ ਬਹੁਤ ਬਾਖੂਬੀ ਪੇਸ਼ ਕੀਤਾ ਗਿਆ ਹੈ ਰੂਪਨਗਰ ਸਤਲੁਜ ਨਦੀ ਦੇ ਕੰਢੇ ਵਸਿਆ ਇੱਕ ਸੋਹਣਾ ਸ਼ਹਿਰ ਹੈ ਜੋ ਕਿ ਪੂਰਬੀ ਪੰਜਾਬ ਰਾਜ ਅਤੇ ਉੱਤਰ ਪੱਛਮੀ ਭਾਰਤ ਨਾਲ ਭਾਰਤ ਵਿੱਚ ਸਥਿਤ ਹੈ ਇੱਥੇ ਪ੍ਰਸਿੱਧ ਇਤਿਹਾਸਿਕ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਹੈ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਜਿੱਥੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਪਾਏ ਗਏ ਹਨ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇੱਕ ਪ੍ਰਸਿੱਧ ਗੁਰਦੁਆਰਾ ਟਿੱਬੀ ਸਾਹਿਬ ਹੈ ਇੱਥੇ ਮਹਾਰਾਜਾ ਰਣਜੀਤ ਸਿੰਘ ਬਾਗ ਹੈ ਜੋ ਕਿ ਕੁਦਰਤੀ ਨਜ਼ਾਰਿਆਂ ਨੂੰ ਪੇਸ਼ ਕਰਦਾ ਹੈ ਇੱਥੇ ਬਹੁਤ ਸਾਰੇ ਆਕਰਸ਼ਿਤ ਕੁਦਰਤੀ ਦ੍ਰਿਸ਼ ਦੇਖਣ ਨੂੰ ਮਿਲਦੇ ਹਨ ਸਤਲੁਜ ਨਦੀ ਦੇ ਕੰਢੇ 'ਤੇ ਬਣਿਆ ਕਿੱਕਰ ਵਾਟਰਫਰਨਟ ਜਿੱਥੇ ਕਿ ਖਾਣ ਖਾਣ ਲਈ ਵੱਖ ਵੱਖ ਵਸਤੂਆਂ ਮੌਜੂਦ ਹਨ ਅਤੇ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਹੈ ਇਹ ਸ਼ਹਿਰ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ ਅਤੇ ਇੱਥੋਂ ਦਾ ਵਾਤਾਵਰਨ ਬਾਕੀ ਸ਼ਹਿਰਾਂ ਦੇ ਮੁਕਾਬਲੇ ਬਹੁਤ ਸਾਫ ਸੁਥਰਾ ਅਤੇ ਸਵੱਛ ਹੈ